ਇੱਕ ਲੱਖ ਪੰਜ ਸੌ ਪੰਜ ਇੱਕ ਲੱਖ ਦਸ ਹਜ਼ਾਰ ਇੱਕ ਲੱਖ ਵੀਹ ਹਜ਼ਾਰ ਇੱਕ ਲੱਖ ਪੰਜਾਹ ਹਜ਼ਾਰ ਇੱਕ ਲੱਖ ਅੱਠ ਹਜ਼ਾਰ